ਹਾਂਜੀ ਬਾਈ ਜੀ ਮੈਂ ਤੁਹਾਨੂੰ ਟੈਕਸੀ ਲੈਣ ਲਈ ਫੋਨ ਕੀਤਾ ਸੀਗਾ ਮੈਂ ਹਰਮਿੰਦਰ ਸਾਹਿਬ ਜਾਣਾ ਹੈ ਤੁਸੀਂ ਪਹਿਲੇ ਨਾਲੋਂ ਹੁਣ ਰੇਟ ਵੱਧ ਮੰਗ ਰਹੇ ਹਨ ਕਿ ਮੇਰੇ ਚਾਰ ਪੰਜ ਦੋਸਤ ਮੇਰੇ ਨਾਲ ਜਾ ਰਹੇ ਹਨ ਰੇਟ ਠੀਕ ਠੀਕ ਲਗਾਓ ਅਤੇ ਅੱਗੇ ਵੀ ਤੁਹਾਡੀ ਟੈਕਸੀ ਅਸੀਂ ਹਰ ਉਹਦੇ ਲੈ ਕੇ ਜਾਂਦੇ ਹਨ